ਹੈਲੋ ਸਤਿ ਸ਼੍ਰੀ ਅਕਾਲ ਸਰ ਫਲਿਪ ਕਾਟ ਕਸਟਮਰ ਕੇਅਰ ਨਾਲ ਗੱਲ ਹੋ ਰਹੀ ਸਰ ਮੇਰੀ ਹਾਂਜੀ ਸਰ ਮੈਂ ਵੰਸ਼ ਗੱਲ ਕਰ ਰਿਹਾ ਪਠਾਨਕੋਟ ਤੋਂ ਜੀ ਸਰ ਮੈਂ ਨਾ ਰੀਸੈਂਟਲੀ ਤੁਹਾਡੀ ਵੈਬਸਾਈਟ ਦੇ ਥਰੂ ਇੱਕ ਔਡਰ ਪਲੇਸ ਕੀਤਾ ਸੀਗਾ ਆਈਫੋਨ ਫ਼ੋਰਟੀਨ ਪ੍ਰੋ ਮੈਕਸ ਦਾ ਡੇਟ ਜਦੋਂ ਮੈਂ ਔਡਰ ਪਲੇਸ ਕੀਤਾ ਸੀਗਾ ਉਦੋਂ ਬਾਰਾਂ ਮਾਰਚ ਸੀਗੀ ਹਾਂਜੀ ਅਤੇ ਔਡਰ ਦੀ ਡਿਲਿਵਰੀ ਡੇਟ ਸੀਗੀ ਅਠਾਰਾਂ ਮਾਰਚ ਦੋ ਹਜ਼ਾਰ ਤੇਈ ਅਤੇ ਟਰਾਂਜੈਕਸ਼ਨ ਮੈਂ ਔਨਲਾਈਨ ਕਰ ਦਿੱਤੀ ਸੀਗੀ ਉਹਦੀ ਹਾਂਜੀ ਅਤੇ ਜਦੋਂ ਜੋ ਡਿਲਿਵਰੀ ਡੇਟ ਸੀਗੀ ਤੇ ਉਸ ਤੋਂ ਕਾਫੀ ਲੇਟ ਮੈਨੂੰ ਆਹ ਪ੍ਰੋਡਕਟ ਮਿਲ ਰਿਹਾ ਅਤੇ ਜਦੋਂ ਅੱਜ ਮਤਲਬ ਪ੍ਰੋਡਕਟ ਮੈਂ ਆਇਆ ਮੇਰੇ ਕੋਲੋਂ ਅਤੇ ਜਦੋਂ ਮੈਂ ਵੇਖ ਰਿਹਾ ਤਾਂ ਇਹਦੇ ਵਿੱਚ ਆਈਫੋਨ ਫ਼ੋਰਟੀਨ ਪ੍ਰੋ ਮੈਕਸ ਤਾਂ ਹੈ ਨਹੀਂ ਡੀਫ਼ੈਕਟਿਵ ਪੀਸ ਨਿਕਲਿਆ ਆਈਫੋਨ ਫ਼ੋਰਟੀਨ ਪ੍ਰੋ ਮੈਕਸ ਦਾ ਜਿਹੜਾ ਕਿ ਮੈਨੂੰ ਲੱਗ ਰਿਹਾ ਕਿ ਆਲਰੈਡੀ ਯੂਸਡ ਹੈਗਾ ਹਾਂਜੀ ਅਤੇ ਸਰ ਪਲੀਜ਼ ਕੈਨ ਵੀ ਰਿਪਲੇਸ ਦਿਸ ਪ੍ਰੋਡਕਟ ਅਦਰਵਾਈਜ਼ ਕਿਉਂਕਿ ਦਿਸ ਕੋਜ਼ ਅਲੋਟ ਓਫ ਪ੍ਰੋਬਲਮ ਫੋਰ ਮੀ ਐਂਡ ਸੰਮਵੰਨ ਹੂ ਹੈਵ ਪੇਡ ਅਲੋਟ ਔਫ ਮਨੀ ਐਂਡ ਗੈਟਿੰਗ ਸੰਮਥਿੰਗ ਵੈਰੀ ਬੈਡ ਇੰਨ ਰਿਟਰਨ ਹਾਂਜੀ ਸਰ ਬਹੁਤ ਭਲੇਮਾਨਸੀ ਹੋਏਗੀ ਤੁਹਾਡੀ ਜੇ ਤੁਸੀਂ ਮਤਲਬ ਇਸ ਚੀਜ਼ 'ਤੇ ਜਲਦੀ ਤੋਂ ਜਲਦੀ ਕੋਈ ਹੀਲਾ ਕੱਢ ਲਓ ਹਾਂਜੀ ਥੈਂਕ ਯੂ ਸਰ ਹਾਂਜੀ ਮੈਂ ਤੁਹਾਨੂੰ ਮਤਲਬ ਸ਼ੇਅਰ ਕਰ ਦਾਗਾ ਇਹਦੀ ਡੀਟੇਲ ਸਾਰੀਆਂ ਇਸੇ ਨੰਬਰ 'ਤੇ ਹਾਂਜੀ ਥੈਂਕ ਯੂ ਸੋ ਮਚ ਸਰ ਥੈਂਕ ਯੂ